ਹਾਂਜੀ ਕੀ ਹਾਲ ਹੈ ਜੀ ਹਾਂਜੀ ਯਾਰ ਪਿੰਡਾਂ 'ਚ ਕੋਈ ਸੁਵਿਧਾ ਨਹੀਂ ਹੈਗੀ ਪਿੰਡਾਂ 'ਚ ਪਹਿਲੀ ਗੱਲ ਤਾਂ ਜੀ ਸੱਤ ਵਜੇ ਤੋਂ ਬਾਅਦ ਕੋਈ ਬੰਦਾ ਨਹੀਂ ਦਿੱਖਦਾ ਜੀ ਸ਼ਹਿਰ 'ਚ ਆਪਾਂ ਅੱਠ ਵਜੇ ਨੌਂ ਵਜੇ ਦਸ ਵਜੇ ਰਾਤ ਦਾ ਕੋਈ ਚੀਜ਼ ਦੀ ਲੋੜ ਪਵੇ ਰਾਸ਼ਨ ਦੀ ਭਾਵੇਂ ਮੈਡੀਕਲ ਅਰਜੈਂਸੀ ਆ ਭਾਵੇਂ ਕਿਸੇ ਚੀਜ਼ ਦੀ ਵੀ ਲੋੜ ਪਏ ਆਪਾਂ ਨੂੰ ਅਵੇਲੇਬਿਲਟੀ ਹੈਗੀ ਆ ਸ਼ਹਿਰ 'ਚ ਸ਼ਹਿਰ 'ਚ ਨਵੀਆਂ ਨਵੀਆਂ ਚੀਜ਼ਾਂ ਹਰ ਵੇਲੇ ਅਪ ਟੂ ਡੇਟ ਆਪਾਂ ਰਹੀ ਦਾ ਕੋਈ ਨਵੀਂ ਚੀਜ਼ ਆਵੇ ਸਭ ਤੋਂ ਪਹਿਲੇ ਸ਼ਹਿਰ ਆਉਂਦੀ ਹੈ ਪਿੰਡ 'ਚ ਬਾਅਦ 'ਚੋ ਆਉਂਦੀ ਏ ਸੋ ਆਪਦੇ ਆਪ ਨੂੰ ਅਪ ਟੂ ਡੇਟ ਰੱਖਿਆ ਜਾ ਸਕਦਾ ਹੈ ਸ਼ਹਿਰਾਂ ਵਿੱਚ ਵੀ ਹੈਗੀਆਂ ਨੇ ਚੰਗੇ ਸਕੂਲ ਚੰਗੇ ਕਾਲਜ ਹੈਗੇ ਬੱਚਿਆਂ ਨੂੰ ਪੜ੍ਹਾਉਣ ਲਈ ਨਾਲੇ ਨੇੜੇ ਆ ਬੱਚਿਆਂ ਨੂੰ ਦੂਰ ਨਹੀਂ ਭੇਜਣਾ ਪੈਂਦਾ ਪਿੰਡ ਬੰਦਾ ਰਵੇ ਤਾਂ ਉਥੋਂ ਪਹਿਲੇ ਪੰਦਰਾਂ ਕਿਲੋਮੀਟਰ ਦਸ ਕਿਲੋਮੀਟਰ ਆਉਣਾ ਜਾਣਾ ਸਫ਼ਰ ਬੱਚੇ ਲਈ ਮੁਸ਼ਕਿਲ ਹੈਗੇ ਜਲਦੀ ਉੱਠੋ ਸ਼ਾਮ ਨੂੰ ਘਰੇ ਲੇਟ ਪਹੁੰਚੋ ਕਹਿਣਾ ਚਾਹਦਾ ਲੋਕਲ ਭੇਜਿਆ ਬੱਚੇ ਨੂੰ ਪੜ੍ਹ ਕੇ ਅਗਰ ਸ਼ਾਮ ਨੂੰ ਟਿਊਸ਼ਨ ਵੀ ਭੇਜਦੇ ਮੈਡਮ ਨਾਲ ਸਾਮ ਨੂੰ ਆਪਾਂ ਭੇਜ ਸਕਦੇ ਹਾਂ ਸੁਵਿਧਾ ਹਰ ਚੀਜ਼ ਦੀ ਸੁਵਿਧਾ ਹੈਗੀ ਸ਼ਹਿਰ ਦੇ ਵਿੱਚ ਸ਼ਹਿਰ ਦੀਆਂ ਸੜਕਾਂ ਵਧੀਆ ਨੇ ਚੌੜੀਆਂ ਸੜਕਾਂ ਨੇ ਪਾਣੀ ਨਹੀਂ ਰੁਕਦਾ ਜੀ ਪਿੰਡਾਂ ਵਿੱਚ ਗਰੱਬ ਹੈਗਾ ਜੀ ਮਿੱਟੀ ਹੈ ਜੀ ਮਿੱਟੀ ਚਿੱਕੜ ਹੈਗੇ ਜੀ ਚਿੱਕੜ 'ਚ ਡਿੱਗ ਸਕਦੇ ਆ ਜੀ ਉੱਥੇ ਟਾਵਰ ਵੀ ਘੱਟ ਨੇ ਰੇਂਜ ਘੱਟ ਆਉਂਦੀ ਪਿੰਡਾਂ ਚ ਪਿੰਡਾਂ ਚ ਅਸਰ ਵਿੱਚ ਘੱਟ ਹੈਗੀ ਸ਼ਹਿਰਾਂ ਚ ਆਪਾਂ ਫੋਨ 'ਤੇ ਗੱਲਬਾਤ ਕਰਨੀ ਹੈ ਕਰ ਸਕਦੇ ਹਾਂ ਜੀ ਚੰਗਾ ਖਾਣ ਪੀਣ ਰੈਸਟੋਰੈਂਡ ਹੈਗਾ ਘਰੇ ਕੋਈ ਗੈਸਟ ਆਉਂਦਾ ਉਹਨੂੰ ਆਪਾਂ ਲੈ ਕੇ ਜਾ ਸਕਦੇ ਹਾਂ ਪਿੰਡਾਂ 'ਚ ਇੰਨੇ ਹੈ ਨਹੀਂ ਨਹੀਂ ਕਟਿੰਗ ਕਰਾ ਦੇ ਟੇਲਰ ਹੈਗੇ ਨੇ ਇਥੇ ਵੱਡੇ ਵੱਡੇ ਸ਼ੋਰੂਮ ਵਾਲੇ ਜਿਹੜੇ ਪਿੰਡਾਂ 'ਚ ਟੇਲਰ ਨਹੀਂ ਬੈਠੇ ਪਿੰਡਾਂ ਵਾਲੇ ਵੀ ਇੱਥੇ ਆਉਂਦੇ ਆ ਕੱਪੜੇ ਸਿਵਾਉਣ ਚੰਗੇ ਚੰਗੇ ਕੱਪੜੇ ਸਿਵਾਉਣ ਬੂਟ ਲੈਣ ਟੈਂਪੋ ਲੈਣ ਹਰ ਤਰਾਂ ਦੇ ਮਨਿਆਰੀ ਵਾਲੇ ਬੈਠੇ ਆ ਜੀ ਕਰਿਆਨੇ ਵਾਲੇ ਹੈਗੇ ਅੱਛਾ ਜੀ ਪਿੰਡਾ 'ਚ ਲਿਮਟਿਡ ਜਿਹੇ ਘਰ ਹੋਣਗੇ ਜੀ ਤੁਹਾਡੀ ਇੱਕ ਗਲੀ 'ਚ ਪੰਜ ਸੱਤ ਘਰ ਹੋਣਗੇ ਸ਼ਹਿਰ ਤਾਂ ਤੁਹਾਨੂੰ ਜਾਣ ਪਛਾਣ ਵੱਧਦੀ ਹੈ ਸੋਸ਼ਲ ਨੈਟਵਰਕ ਵੱਧਦਾ ਚਾਰ ਬੰਦੇ ਮਿਲਦੇ ਨੇ ਸ਼ਾਮ ਨੂੰ ਬੁਲਾ ਕੇ ਲੰਘਦੇ ਹੈ ਪਿੰਡਾਂ 'ਚ ਘਰੇ ਬੰਦਾ ਰਹਿ ਜਾਂਦਾ ਟਾਈਮਲੀ ਲੇਡੀਜ ਨੇ ਜਾਣਾ ਬੁਟੀਕ 'ਤੇ ਜਾਣਾ ਕੱਪੜੇ ਸਿਵਾਉਣ ਨੇੜੇ ਹੈਗਾ ਜੀ ਨਵੇਂ ਫੈਸ਼ਨ ਵਾਲੇ ਕੱਪੜੇ 'ਚ ਵੀ ਜਾਂਦੇ ਆ ਜੀ ਪਿੰਡਾਂ ਚੋਂ ਹੀ ਉਹ ਥੋੜ੍ਹਾ ਫੈਸ਼ਨ ਲੇਟ ਆਉਂਦਾ ਜੀ ਜਿਹੜੇ ਉਥੇ ਟੇਲਰ ਨਹੀਂ ਹੈਗੇ ਉੱਦਾਂ ਦੇ ਅਪ ਟੂ ਡੇਟ ਇਹ ਚੀਜ਼ਾਂ ਮਾਅਨੇ ਰੱਖਦੀਆਂ ਨੇ ਸ਼ਹਿਰ ਦੀ ਜ਼ਮੀਨ ਥੋੜ੍ਹੀ ਮਹਿੰਗੀ ਹੈ ਪਿੰਡਾਂ ਵਾਲੀ ਰਹਿੰਦੇ ਆ ਉਹ ਥੋੜ੍ਹੀ ਸਸਤੀ ਹੈ ਸ਼ਹਿਰ 'ਚ ਪਲਾਟ ਨੂੰ ਥੋੜ੍ਹੇ ਮਹਿੰਗੇ ਮਿਲਣੇ ਨੇ ਪਰ ਮਿਲਣੇ ਸਾਫ਼ ਸੁਥਰੇ ਵਧੀਆ ਘਰ ਬਾਰ ਮਿਲਣਾ ਤੁਹਾਨੂੰ ਚੌੜੀਆਂ ਸੜਕਾਂ ਗੱਡੀ ਲਾ ਸਕਦੇ ਆਰਾਮ ਨਾਲ ਖੁੱਲ੍ਹੇ ਮਕਾਨ ਨੇ

ਕੋਈ ਗੱਲ ਨਹੀਂ ਦੱਸ ਦਿਓ ਜੇ ਆਪਣਾ ਏਜੰਟ ਹੈਗਾ ਜੀ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਚੰਦਰ ਪ੍ਰਕਾਸ਼ ਕੁਕੜ ਉਹਨੂੰ ਕਹਿ ਦਿੰਦੇ ਹਾਂ ਜੀ ਉਹ ਤੁਹਾਡੇ ਨਾਲ ਲੱਭ ਦੇਵੇਗਾ ਘਰ ਕੋਈ ਸ਼ਹਿਰ 'ਚ ਚੰਗਾ ਉਹਦਾ ਕੰਮ ਵੀ ਇਹ ਹੈ ਜੀ ਠੀਕ ਹੈ ਜੀ